ਅੱਜ ਕੱਲ੍ਹ ਆਮ ਦੇਖਿਆ ਗਿਆ ਹੈ ਕਿ ਕਿਸਾਨ ਜਿਮੀਂਦਾਰ ਖੁਦਕੁਸ਼ੀ ਬਹੁਤ ਕਰਨ ਲੱਗ ਪਏ ਹਨ ਜਿਹਦੇ ਪਿੱਛੇ ਅਨੇਕਾਂ ਹੀ ਕਾਰਨ ਹਨ ਨੰਬਰ ਇੱਕ ਸਰਕਾਰ ਇੰਨਾ ਉਨ੍ਹਾਂ ਨੂੰ ਕਰਜ਼ਾ ਮੁਆਫ ਨਹੀਂ ਕਰਦੀ ਨਾ ਉਨ੍ਹਾਂ ਨੂੰ ਦੇ ਰਹੀ ਹੈ ਤਾਂ ਕਿ ਉਹ ਇਸ ਤੋਂ ਬਚ ਸਕਣ ਦੂਸਰੇ ਨੰਬਰ 'ਤੇ ਜਿਹੜੇ ਆੜ੍ਹਤੀ ਹੈ ਉਹ ਵੀ ਕਿਸਾਨਾਂ ਨੂੰ ਤੰਗ ਕਰਦੇ ਹਨ ਇੱਥੋਂ ਤੱਕ ਕਿ ਦਸ ਰੁਪਈਏ ਦੇ ਕੇ ਸੌ ਰੁਪਈਏ ਐਂਟਰੀ ਕਰ ਜਾਂਦੇ ਹਨ ਜਦੋਂ ਉਹ ਪੁੱਛਦੇ ਹਨ ਕਿੰਨੇ ਪੈਸੇ ਹਨ ਤਾਂ ਉਹ ਦਸ ਤੋਂ ਸੌ ਬਚਾਉ ਕਹਿੰਦੇ ਹਨ ਇਸ ਢੰਗ ਦੇ ਨਾਲ ਉਹ ਬੇਚਾਰੇ ਕਾਫੀ ਮਜ਼ਬੂਰ ਹੋ ਕੇ ਆਪਣੀ ਜਾਨ ਕੁਰਬਾਨ ਕਰਦੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਆੜ੍ਹਤੀਆਂ ਪਰ ਕੁਛ ਕੰਟਰੋਲ ਕਰੇ ਅਤੇ ਕਿਸਾਨਾਂ ਨੂੰ ਬਿਨਾ ਵਿਆਜ ਕਰਜ਼ਾ ਦਿੱਤਾ ਜਾਵੇ ਤਾਂ ਕਿ ਉਹ ਚੰਗਾ ਜੀਵਨ ਬਤੀਤ ਕਰ ਸਕਣ